ਹੈਲੋ ਹਾਂਜੀ ਹਾਂਜੀ ਹਾਂ ਹਾਂ ਪਠਾਨਕੋਟ ਦੇ ਵਿੱਚ ਨਾ ਇੱਕ ਟੀਚਰ ਦੀ ਜੋਬ ਬਹੁਤ ਅੱਛੀ ਮਿਲੇ ਕਰਦੀ ਹੈ ਇੱਕ ਨਰਸ ਦੀ ਜੋਬ ਹੈਗੀ ਹੈ ਕੀ ਆ ਔਰ ਇਕ ਨਾ ਸ਼ੋਪ 'ਤੇ ਕੰਮ ਕਰਨ ਦਾ ਹੈਗਾ ਅਤੇ ਟੀਚਰ ਦੀ ਜੋਬ ਹੈ ਉਹਦੇ ਵਿੱਚ ਤੁਹਾਨੂੰ ਸੈਲਰੀ ਕੋਈ ਦੱਸ ਕੁ ਹਜ਼ਾਰ ਮਿਲ ਜਾਏਗੀ ਔਰ ਜਿਹੜੀ ਨਰਸ ਦੀ ਜੋਬ ਆ ਉਹਦੇ ਵਿੱਚ ਤੁਹਾਨੂੰ ਸੈਲਰੀ ਕੋਈ ਅੱਠ ਕੁ ਹਜ਼ਾਰ ਹੈਗੀ ਹੈ ਹਾਂਜੀ ਔਰ ਜੋ ਸ਼ਾਪ 'ਤੇ ਅਗਰ ਕੰਮ ਕਰਨਾ ਹੈ ਤਾਂ ਉਹਦੇ ਵਿੱਚ ਤੁਹਾਨੂੰ ਨੌਂ ਦਸ ਦੇ ਵਿੱਚ ਸੈਲਰੀ ਮਿਲ ਜਾਏਗੀ ਪਠਾਨਕੋਟ ਦੇ ਵਿੱਚ ਅਤੇ ਫਿਰ ਇਹ ਹੀ ਜੋਬਸ ਅਵੇਲੇਬਲ ਹੈਗੀ ਇਸ ਟਾਈਮ ਹਾਂਜੀ ਹਾਂਜੀ ਹਾਂਜੀ ਮੈਂ ਜੋਬ ਕਰਦੀ ਹਾਂ ਮੈਂ ਟੀਚਰ ਹਾਂ ਹਾਂਜੀ ਮੈਨੂੰ ਦਸ ਹਜ਼ਾਰ ਸੈਲਰੀ ਮਿਲਦੀ ਹੈ ਜੀ ਹਾਂਜੀ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਮੈਂ ਤੁਹਾਨੂੰ ਦੱਸਾਂਗੀ ਮੈਂ ਤੁਹਾਨੂੰ ਇਨਫੋਰਮ ਕਰਾਂਗੀ ਕੋਈ ਅੱਛੀ ਟੀਚਰ ਦੀ ਇਸ ਟਾਈਮ ਮੇਰੇ ਸਕੂਲ ਵਿੱਚ ਅਤੇ ਟੀਚਰ ਦੀ ਜੋਬ ਬਹੁਤ ਅੱਛੀ ਮਿਲੇ ਕਰਦੀ ਹੈ ਜੇ ਤੁਸੀਂ ਕਰਨੀ ਹੈ ਤਾਂ ਮੈਂ ਤੁਹਾਡੀ ਗੱਲ ਕਰਵਾ ਦਿੰਦੀ ਹਾਂ